ਹਾਂਜੀ ਸਤਿ ਸ਼੍ਰੀ ਅਕਾਲ

ਠੀਕ ਹੈ ਜੀ ਕੋਈ ਨਹੀਂ ਮੋਸਟ ਵੈਲਕ ਇਹੀ ਕੰਮ ਹੈ ਆਪਾਂ ਜਿਹੜੇ ਟੂਰਿਸਟ ਹੁੰਦੇ ਨੇ ਉਹ ਨੂੰ ਸਰਵਿਸ ਪ੍ਰੋਵਾਈਡ ਕਰਨਦੇ ਆ ਤੁਸੀਂ ਕ ਆਉਣਾ ਕਦੋਂ ਹੈ ਠੀਕ ਹੈ ਮੈਡਮ ਮੋਸਟ ਵੈਲਕਮ ਆਪਣਾ ਮੈਡਮ ਇਸ ਤਰ੍ਹਾਂ ਹੈ ਜੇ ਤੁਸੀਂ ਰੇਸੀਡੇਂਸ਼ ਤੁਹਾਡਾ ਰਹੇਗਾ ਅਤੇ ਸ੍ਟੇ ਵਗੈਰਾ ਦਾ ਅਕੋਮੋਡੇਸ਼ਨ ਪੰਜ ਹਜ਼ਾਰ ਰੁਪਏ ਆ ਜੇ ਤੁਸੀਂ ਰਿਹਾਇਸ਼ ਵੀ ਵਿੱਚ ਲੈਣੀ ਹੈ ਅਸੀਂ ਤੁਹਾਨੂੰ ਪਿੱਕ ਵੀ ਕਰਾਂਗੇ ਵਾਹਗਾ ਬਾਰਡਰ ਦਿਖਾਵਾਂਗੇ ਸਵੇਰੇ ਸੈਰਮਨੀ ਹੁੰਦੀ ਹੈ ਸ਼ਾਮ ਨੂੰ ਝੰਡਾ ਫਿਰਾਇਆ ਜਾਂਦਾ ਦੋਨੋਂ ਟਾਈਮ ਦੀ ਤੁਹਾਨੂੰ ਪਰੇਡ ਦਿਖਾਵਾਂਗੇ ਗੋਲਡਲ ਟੰਪ ਟੈਂਪਲ ਦਰਬਾਰ ਤੱਕ ਸਾਹਿਬ ਤੱਕ ਟਰਾਂਸਪੋਰਟੇਸ਼ਨ ਦਾ ਸਾਰਾ ਖਰਚਾ ਸਾਡਾ ਹੋਏਗਾ ਪੰਜਾਹ ਪਰਸੇੰਟ ਮੈਡਮ ਅਸੀਂ ਐਡਵਾਂਸ ਲਵਾਂਗੇ ਹਾਂ ਮੈਡਮ ਸਾਡੀ ਸਾਈਟ 'ਤੇ ਸਾਡੇ ਦੋ ਨੰਬਰ ਦਿੱਤੇ ਹੋਏ ਨੇ ਕਈ ਵਾਰੀ ਇੱਕ ਨੰਬਰ ਨਹੀਂ ਲੱਗਦਾ ਦੂਸਰੇ ਨੰਬਰ ਤੁਸੀਂ ਕਾਲ ਕਰ ਸਕਦੇ ਹੋ

ਠੀਕ ਹੈ ਮੈਮ ਓਕੇ ਮੈਮ ਮੈਡਮ ਹਮੇਸ਼ਾ ਸਵਾਗਤ ਹੈ ਜੀ ਅੰਮ੍ਰਿਤਸਰ ਦੇ ਵਿੱਚ ਤੁਹਾਡਾ ਵੈਲਕਮ